ਸਰਦਾਰ ਬਲਵਿੰਦਰ ਸਿੰਘ ਜੀ ਅਤੇ ਸਰਦਾਰ ਤਲਵੀਰ ਸਿੰਘ ਜੀ ਅਤੇ ਸਰਦਾਰ ਅਜੈਬ ਸਿੰਘ ਜੀ ਅਤੇ ਸਰਦਾਰਨੀ ਗੁਰਮੀਤ ਕੌਰ ਅਤੇ ਸਾ ਸਰਦਾਰਨੀ ਸਰਬਜੀਤ ਕੌਰ